ਹਾਂਜੀ ਔਨਲਾਈਨ ਦੀ ਤਾਂ ਬਹੁਤ ਜ਼ਿਆਦਾ ਸੁਵਿਧਾ ਹੋ ਗਈ ਹੈ ਲੋਕਡਾਊਨ ਦੇ ਵਿੱਚ ਮੋਬਾਈਲ ਲ ਲੈਪਟੋਪ ਦੀ ਜ਼ਿਆਦਾ ਵਰਤੋਂ ਹੋਈ ਸੀ ਅਤੇ ਹੁਣ ਹੁਣ ਵੀ ਹੋ ਰਹੀ ਹੈ ਅਤੇ ਇਹ ਨਾ ਬਹੁਤ ਵਧੀਆ ਹੈ ਸਕੀਮ ਹੈ ਸਰਕਾਰ ਦੀ ਜਿਸ ਤਰ੍ਹਾਂ ਨਾ ਸਾਨੂੰ ਪਹਿਲਾਂ ਪਤਾ ਨਹੀਂ ਲੱਗਦਾ ਸੀ ਵੀ ਬੱਚੇ ਸਕੂਲ ਜਾ ਰਹੇ ਹੈ ਨਹੀਂ ਜਾ ਰਹੇ ਹੈ ਹੁਣ ਸਾਨੂੰ ਅਟੈਂਡਸ ਦੀ ਹਰ ਚੀਜ਼ ਮੋਬਾਈਲ 'ਤੇ ਗਰੁੱਪ ਬਣਾ ਕੇ ਮੈਡਮ ਵੀ ਪਾ ਦਿੰਦੀ ਹੈ ਸਾਡੇ ਹਸਬੈਂਡ ਵੀ ਅਹ ਔਨਲਾਈਨ ਜ਼ਿਆਦਾ ਕੰਮ ਕਰਦੇ ਹਾਂ ਮਤਲਬ ਜ਼ਿਆਦਾ ਉਹਨਾਂ ਦੀ ਟਾਈਮਿੰਗ ਬਹੁਤ ਬੱਚ ਗਈ ਹੈ ਪਹਿਲਾਂ ਦੇ ਮੁਕਾਬਲੇ ਬਹੁਤ ਵਧੀਆ ਹੈ ਸਿਸਟਮ